ਸਤਿ ਸ਼੍ਰੀ ਅਕਾਲ ਭਾਅ ਜੀ ਹੋਰ ਵਧੀਆ ਹੋ ਜੀ ਬਲਰਾਜ ਆਟੋ ਯੂਨੀਅਨ ਤੋਂ ਗੱਲ ਕਰਦੇ ਹੋ ਜੀ ਠੀਕ ਆ ਜੀ ਅਤੇ ਮੈਂ ਇੱਧਰ ਨਵਾਂਸ਼ਹਿਰ ਵੱਲ ਨਾ ਮੇਰੀ ਟਰੇਨ ਦੀ ਦਸ ਕੁ ਵਜੇ ਰਾਤ ਨੂੰ ਲੇਟ ਹੋ ਜਾਣਾ ਜੀ ਅਤੇ ਤੁਸੀਂ ਜਿਹੜੀ ਮੈਂ ਸੁਣਿਆ ਕਿ ਤੁਹਾਡੇ ਆਟੋ ਦੀ ਸਰਵਿਸ ਬਹੁਤ ਵਧੀਆ ਹੈ ਰਾਤ ਬਰਾਤ ਤੁਸੀਂ ਅ ਮੁਹੱਈਆ ਕਰਵਾ ਦਿੰਦੇ ਹੋ ਆਟੋ ਸਰਵਿਸ ਅਤੇ ਮੇਰਾ ਨਵਾਂਸ਼ਹਿਰ ਦੇ ਜਿੱਥੇ ਰੈਲਮਾਜਰਾ ਪਿੰਡ ਆ ਉਹਦੇ ਕੋਲ ਘਰ ਆ ਅਤੇ ਅਗਲੀ ਸਵੇਰ ਨਾ ਤੁਸੀਂ ਮੈਨੂੰ ਉੱਥੋਂ ਪਿੱਕ ਕਰ ਸਕਦੇ ਹੋ ਠੀਕ ਆ ਜੀ ਧੰਨਵਾਦ